ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਪ੍ਰੀਤ ਸਿੰਘ ਬੋਲ ਰਿਹਾ ਤੁਸੀਂ ਊਬਰ ਤੋਂ ਗੱਲ ਕਰ ਰਹੇ ਜੇ ਸਰ ਮੈਂ ਨਾ ਕੱਲ੍ਹ ਏਅਰਪੋਰਟ ਜਾਣ ਲਈ ਕੈਬ ਬੁੱਕ ਕੀਤੀ ਆ ਮੇਰੀ ਫਲਾਈਟ ਸਵੇਰੇ ਦਸ ਵਜੇ ਆ ਅਤੇ ਸਾਢੇ ਪੰਜ ਵਜੇ ਤੁਸੀਂ ਮੇਰੇ ਕੋਲ ਪਹੁੰਚ ਜਿਓ ਸੱਤ ਵਜੇ ਮੇਰਾ ਚੈੱਕਿਨ ਆ ਪਲੀਜ਼ ਲੇਟ ਨਾ ਕਰਿਓ ਪੂਰੇ ਸਾਢੇ ਪੰਜ ਪਹੁੰਚ ਜਾਇਓ ਅਤੇ ਗੱਡੀ ਮੈਂ ਇਨੋਵਾ ਕ੍ਰਿਸ਼ਚਾ ਕਹੀ ਆ ਉਹਦੇ ਉੱਪਰ ਰੂਫ ਕੈਰੀਅਰ ਲੱਗਾ ਹੋਵੇ ਅਤੇ ਗੱਡੀ ਦੀ ਡਿੱਗੀ ਵੀ ਚੰਗੀ ਤਰ੍ਹਾਂ ਖਾਲੀ ਹੋਵੇ ਮੇਰਾ ਲਗਿਜ ਬਹੁਤ ਜ਼ਿਆਦਾ ਵਾ ਅਤੇ ਕੱਲ੍ਹ ਮੇਰੀ ਕੈਨੇਡਾ ਦੀ ਫਲਾਈਟ ਆ ਅਤੇ ਮੈਂ ਸਾਢੇ ਉਹ ਸੱਤ ਵਜੇ ਤੱਕ ਪਹੁੰਚਣਾ ਵਾ ਅਤੇ ਤੁਸੀਂ ਮੇਰੇ ਕੋਲ ਸਾਢੇ ਪੰਜ ਵਜੇ ਪੂਰੇ ਪਹੁੰਚ ਜਾਇਓ ਸਰ ਗੱਡੀ ਸਾਫ ਲੈ ਕੇ ਆਇਓ ਅਤੇ ਰਾਹ 'ਚ ਕੋਈ ਖਰਾਬੀ ਨਾ ਹੋਵੇ ਮੈਂ ਤੁਹਾਨੂੰ ਪੰਜ ਸੱਤ ਸੌ ਰੁਪਏ ਐਕਸਟਰਾ ਟਿੱਪ ਦੇ ਦਾਂਗਾ ਪੈਸਿਆਂ ਦੀ ਤੁਸੀਂ ਟੈਨਸ਼ਨ ਨਾ ਲਿਓ ਬਾਕੀ ਪਲੀਜ਼ ਮੈਨੂੰ ਟਾਈਮ ਸਿਰ ਏਅਰਪੋਰਟ ਪਹੁੰਚਾ ਦਿਓ ਮੇਰੀ ਫਲਾਈਟ ਆ ਮੈਂ ਬਹੁਤ ਅਰਜੈਂਟ ਜਾਣਾ ਵਾਂ ਮੈਂ ਤੁਹਾਡਾ ਬਹੁਤ ਠੈਕ ਠੈਂਕਫੁੱਲ ਹੋਵਾਂਗਾ ਪਲੀਜ਼ ਤੁਸੀਂ ਮੈਨੂੰ ਕੱਲ੍ਹ ਟਾਈਮ ਨਾਲ ਪਹੁੰਚਾ ਦਿਓ ਜੀ